ਮੈਂ ਅਕਸਰ ਹੀ ਯੂਟਿਊਬ ਦੇ ਉੱਤੇ ਡਾਂਸ ਸ਼ੋਟਸ ਦੇਖਦਾ ਰਹਿੰਦਾ ਹਾਂ ਮੈਨੂੰ ਜ਼ਿਆਦਾ ਹਰਿਆਣੇ ਦੀ ਇੱਕ ਲੜਕੀ ਜੋ ਜਿਸਦਾ ਨਾਂ ਸਪਣਾ ਚੌਧਰੀ ਹੈ ਉਸ ਦਾ ਡਾਂਸ ਮੈਨੂੰ ਬਹੁਤ ਪਸੰਦ ਹੈ ਉਹ ਅਕਸਰ ਹੀ ਉਹਦਾ ਜਿਹੜਾ ਅ ਆਪਣਾ ਡਾਂਸ ਕਰਨ ਦਾ ਜੋ ਵੱਖੋ ਵੱਖਰੇ ਅਦਾਵਾਂ ਦੇ ਰਾਹੀਂ ਡਾਂਸ ਕਰਦੀ ਹੈ ਉਹ ਬਹੁਤ ਜ਼ਿਆਦਾ ਹਰੇਕ ਆਪਣੇ ਦਰਸ਼ਕ ਨੂੰ ਆਪਣੇ ਵੱਲ ਖਿੱਚਦੀ ਹੈ ਅਤੇ ਪ੍ਰਭਾਵਿਤ ਕਰਦੀ ਹੈ ਉਸ ਦਾ ਡਾਂਸ ਬਾਕੀਆਂ ਨਾਲੋਂ ਬਾਕੀ ਆਮ ਡਾਂਸਰਾਂ ਨਾਲੋਂ ਮੈਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਹ ਇਹ ਜੋ ਸਪਣਾ ਚੌਧਰੀ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਮਤਲਬ ਕਿ ਬਚਪਨ ਤੋਂ ਹੀ ਇੱਕ ਕਲਾਕਾਰ ਹੋਵੇ ਅਤੇ ਉਹ ਇੰਨੀ ਜ਼ਿਆਦਾ ਮਤਲਬ ਕਿ ਉਹਦੀ ਹਰ ਅਦਾ ਜਿਹੜੀ ਹੈਗੀ ਆ ਵੇਖਣ ਵਾਲਿਆਂ ਦੇ ਮਨ ਨੂੰ ਮੋਹ ਲੈਂਦੀ ਹੈ ਇਸ ਕਰਕੇ ਮੈਨੂੰ ਇਹ ਜੋ ਸਪਣਾ ਚੌਧਰੀ ਆ ਜੋ ਹਰਿਆਣਵੀ ਡਾਂਸਰ ਹੈ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ